ਹਾਂਜੀ ਹਾਂਜੀ ਹਾਂਜੀ ਮੈਡਮ ਦੇਖੋ ਸਿੰਪਲ ਸੂਟ ਦੇ ਤਾਂ ਸੱਤ ਸੌ ਰੁਪਏ ਹੈ ਜੀ ਅਤੇ ਵਧੀਆ ਵਧੀ ਜਾਉਂਗੇ ਫਿਰ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਰੇਟ ਵੀ ਫਿਰ ਹਜ਼ਾਰ ਦੋ ਹਜ਼ਾਰ ਤਿੰਨ ਹਜ਼ਾਰ ਕੋਈ ਚੱਕਰ ਨਹੀਂ ਜੀ ਰੇਟ ਤਾਂ ਕਰ ਲਊਂਗੇ ਤੁਸੀਂ ਕੋਈ ਨਹੀਂ ਸ਼ੋਪ 'ਤੇ ਵਿਜ਼ਿਟ ਕਰਿਓ ਅਤੇ ਹਾਂਜੀ ਫਿਰ ਦੇਖ ਲਵਾਂਗੇ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜੀ ਡਿਜ਼ਾਇਨ ਮੈਂ ਆਪ ਏ ਕਰਦਾ ਸਾਰੇ ਸੂਟ ਕੋਈ ਗੱਲ ਨਹੀਂ ਹੋ ਜਾਵੇਗਾ ਸਾਰਾ ਕੁਛ ਹਾਂਜੀ ਹਾਂਜੀ ਸਾਰਾ ਓਕੇ ਕੋਈ ਗੱਲ ਨਹੀਂ ਬੇਫਿਕਰੇ ਹੋ ਜਾਉ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਬੇਫਿਕਰੇ ਜੀ ਜੀ ਜੀ